ਅਸੀਂ ਹਰ ਤਰ੍ਹਾਂ ਦੇ ਗਲੇ ਤਿਆਰ ਕਰ ਸਕਦੇ ਹਾਂ ਅਸੀਂ ਹਰ ਤਰਾਂ ਦੇ ਗਲੇ ਤਿਆਰ ਸ ਕਰ ਸਕਦੇ ਹਾਂ ਅਸੀਂ ਅਸੀਂ ਮੈਂ ਅਪ ਗਲੇ ਕਈ ਤਰ੍ਹਾਂ ਨਾਲ ਬਣਾ ਸਕਦੀ ਹਾਂ ਜਿਸ ਵਿੱਚ ਅਸੀਂ ਗਲੇ ਬਜ਼ਾਰ ਤੋਂ ਵੀ ਬਣੇ ਬਣਾਏ ਲਿਆਉਂਦੇ ਹਾਂ ਅਤੇ ਫਿਰ ਘਰ ਵਿੱਚ ਵੀ ਉਸ ਦੇ ਅਕੋਡਿੰਗ ਤਿਆਰ ਕਰ ਸਕਦੇ ਹਾਂ ਡਿਜ਼ਾਇਨ ਦੇ ਅਕੋਡਿੰਗ ਤਿਆਰ ਕਰ ਸਕਦੇ ਹਾਂ ਗਲੇ ਗਲੇ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਬਾਜ਼ਾਰ ਦੇ ਗਲਿਆਂ ਦੀ ਕਟਿੰਗ ਵੱਖਰੀ ਹੁੰਦੀ ਹੈ ਅਤੇ ਜੋ ਅਸੀਂ ਆਪਣੀ ਲੋੜ ਅਨੁਸਾਰ ਜਿਸ ਤਰ੍ਹਾਂ ਦਾ ਬਣਾਉਣਾ ਹੋਵੇ ਉਸ ਤਰ੍ਹਾਂ ਦੀ ਅਸੀਂ ਆਰਾਮ ਨਾਲ ਕਟਿੰਗ ਵੀ ਕਰ ਸਕਦੇ ਹਾਂ ਇਸ ਵਿੱਚ ਬਹੁਤਾ ਫਰਕ ਨਹੀਂ ਹੁੰਦਾ ਬਾਕੀ ਡਿਜ਼ਾਇਨਰ ਗਲੇ ਘਰ ਵਿੱਚ ਹੀ ਤਿਆਰ ਕੀਤੇ ਜਾਣ ਤਾਂ ਸਭ ਤੋਂ ਵਧੀਆ ਹੁੰਦੇ ਹਨ ਧੰਨਵਾਦ